ਮੇਰਾ ਇੱਕ ਛੋਟਾ ਜਿਹਾ ਕਾਰੋਬਾਰ ਆ ਮੈਂ ਬੁਟੀਕ ਚਲਾਉਂਦੀ ਹਾਂ ਜਿਸ ਵਿੱਚ ਦੋ ਕਾਰੀਗਰ ਆ ਅਤੇ ਇੱਕ ਹੈਲਪਰ ਲੜਕੀ ਹੈ ਮੈਂ ਔਰਤਾਂ ਦੇ ਕੱਪੜੇ ਸਿਲਦੀ ਹਾਂ ਵੱਖਰੇ ਵੱਖਰੇ ਤਰ੍ਹਾਂ ਦੇ ਸੂਟ ਬਣਾਉਂਦੀ ਹਾਂ ਕਈ ਵਾਰੀ ਸੂਟਾਂ 'ਤੇ ਕਢਾਈ ਕਰਕੇ ਵੀ ਉਹਨਾਂ ਨੂੰ ਸਿਉਂਕੇ ਦਿੰਦੀ ਹਾਂ ਮੈਂ ਇੱਕ ਸੂਟ ਦੀ ਸਵਾਈ ਤਿੰਨ ਸੌ ਰੁਪਈਆ ਕੀਮਤ ਲੈਂਦੀ ਹਾਂ